ਸਤਿ ਸ਼੍ਰੀ ਅਕਾਲ ਮੇਰਾ ਨਾਮ ਮਾਨਿਕਵੀਰ ਸਿੰਘ ਹੈ ਮੈਂ ਕੱਲ੍ਹ ਸੱਤ ਫਰਵਰੀ ਦਿਨ ਬੁੱਧਵਾਰ ਲਈ ਤੁਹਾਡੀ ਕੰਪਨੀ ਤੋਂ ਇੱਕ ਕੈਬ ਬੁੱਕ ਕੀਤੀ ਹੈ ਜਿਸਨੇ ਮੈਨੂੰ ਏਅਰਪੋਰਟ ਤੱਕ ਪਹੁੰਚਾਉਣਾ ਹੈ ਮੈਨੂੰ ਆਪਣੇ ਕੈਬ ਡਰਾਈਵਰ ਵਜੋਂ ਤੁਹਾਡਾ ਨੰਬਰ ਮਿਲਿਆ ਹੈ ਕਿਰਪਾ ਕਰਕੇ ਮੈਨੂੰ ਇਹ ਜਾਣਕਾਰੀ ਪ੍ਰਦਾਨ ਕਰੋ ਕਿ ਤੁਸੀਂ ਕੱਲ੍ਹ ਕਿੰਨੇ ਵਜੇ ਮੇਰੇ ਦਿੱਤੇ ਗਏ ਪਤੇ ਉੱਤੇ ਡਰਾਈਵਰ ਨੂੰ ਭੇਜੋਗੇ ਮੈਂ ਇੱਕ ਵਪਾਰਕ ਮੀਟਿੰਗ ਲਈ ਦਿੱਲੀ ਜਾਣਾ ਹੈ ਇਸ ਲਈ ਕਿਰਪਾ ਕਰਕੇ ਕੈਬ ਸਮੇਂ ਸਿਰ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਜੀ ਧੰਨਵਾਦ